ਯੈੱਸ ਸਰ ਹਾਓ ਕੈਨ ਆਈ ਹੈਲਪ ਯੂ ਸਤਿ ਸ਼੍ਰੀ ਅਕਾਲ ਸਰ ਅੱਛਾ ਜੀ ਅੱਛਾ ਜੀ ਉਹ ਸਰ ਇੱਕ ਸੌ ਮਿਲੀਅਨ ਸਬਸਕ੍ਰਾਈਬਰ ਵਾਲਾ ਹਾਂਜੀ ਹਾਂਜੀ ਦੇਖੋ ਸਰ ਅਸੀਂ ਬੇਸਿਕਲੀ ਬਹੁਤ ਅਲੱਗ ਅਲੱਗ ਰੈਸਿਪੀ ਦੀ ਡੀਲ ਕਰਦੇ ਹਾਂ ਪਰ ਜ਼ਿਆਦਾਤਰ ਪੰਜਾਬ ਦੇ ਵਿੱਚ ਸਰ ਬਹੁਤ ਅਲੱਗ ਅਲੱਗ ਤਰ੍ਹਾਂ ਦੀ ਡਿਸ਼ ਹੁੰਦੀਆਂ ਨੇ ਜਿਵੇਂ ਕਿ ਸਰ ਇੱਥੇ ਸਾਰੇ ਤੋਂ ਜ਼ਿਆਦਾ ਮਸ਼ਹੂਰ ਡਿਸ਼ ਹੈਗੀ ਆ ਜਿਵੇਂ ਕਿ ਜਿਹਨੂੰ ਕਹਿੰਦੇ ਹਾਂ ਆਪਾਂ ਸਰਸੋਂ ਦਾ ਸਾਗ ਅਤੇ ਜ਼ਿਆਦਾਤਰ ਮੱਕੀ ਦੀ ਰੋਟੀ ਨਾਲ ਖਾਧਾ ਜਾਂਦਾ ਸਰ ਅਤੇ ਇਹ ਬਹੁਤ ਜ਼ਿਆਦਾ ਮਸ਼ਹੂਰ ਡਿਸ਼ ਆ ਉਰੇ ਆਪਣੇ ਪੰਜਾਬ ਦੀ ਅਤੇ ਜ਼ਿਆਦਾਤਰ ਲੋਕ ਕਿੰਨੇ ਵੀ ਜਾਂ ਆਹ ਡਿਸ਼ ਨੂੰ ਖਾਣਾ ਪਸੰਦ ਕਰਦੇ ਹਾਂ ਜੀ ਅਤੇ ਬਾਕੀ ਆਪਾਂ ਨੋਨ ਵੈੱਜ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਨੋਨ ਵੈੱਜ ਵਾਸਤੇ ਵੀ ਬਹੁਤ ਜ਼ਿਆਦਾ ਵਰਾਇਟੀ ਆ ਜਿਵੇਂ ਕਿ ਚਿਕਨ ਟਿੱਕਾ ਹੋ ਗਿਆ ਸਰ ਪਨੀਰ ਪਕੌੜਾ ਹੋ ਗਿਆ ਜੀ ਅਤੇ ਬਾਕੀ ਵੀ ਹੋਰ ਅਲੱਗ ਅਲੱਗ ਤਰ੍ਹਾਂ ਦੀ ਹੋਊਗੀ ਜੇ ਸਰ ਤੁਹਾਡੀ ਕੋਈ ਸਪੈਸ਼ਲ ਡਿਮਾਂਡ ਆ ਆਪਾਂ ਉਹ ਵੀ ਚੀਜ਼ ਮੰਗਾ ਸਕਦੇ ਹਾਂ ਨੋਨ ਵੈੱਜ ਸਰ ਜਿਵੇਂ ਕਿ ਹੋ ਗਿਆ ਚਿਕਨ ਟਿੱਕਾ ਹੋ ਗਿਆ ਜੀ ਅਤੇ ਚਿਕਨ ਪਕੌੜਾ ਹੋ ਗਿਆ ਉਹ ਪੂਰਾ ਪ੍ਰੋਪਰ ਗ੍ਰਿਲ ਗ੍ਰਿਲਡ ਹੋਊਗਾ ਅਤੇ ਆਪਣੇ ਕਰੀਬ ਸਿਟੀ ਜਿਹਨੂੰ ਆਪਾਂ ਖੰਨੇ ਨੂੰ ਜਿਵੇਂ ਬੋਲਦੇ ਹਾਂ ਅਤੇ ਆਪਣਾ ਇਹ ਸਾਲ ਭਰ ਮਸ਼ਹੂਰ ਹੁੰਦਾ ਹੈ ਅਤੇ ਇੱਥੇ ਬਹੁਤ ਅਲੱਗ ਅਲੱਗ ਤਰ੍ਹਾਂ ਦੇ ਸਪਾਈਸਿਸ ਵੀ ਇਹਦੇ ਉੱਪਰ ਪਾਏ ਜਾਂਦੇ ਆ ਅਤੇ ਲਗਭਗ ਤੀਹ ਤਰ੍ਹਾਂ ਦੇ ਸਪਾ ਸਪਾਈਸਿਸ ਜਿਹੜੇ ਮਸਾਲੇ ਹੁੰਦੇ ਆ ਉਹਦੇ ਵਿੱਚ ਜਦੋਂ ਨਾ ਟਿੱਪ ਕਰਕੇ ਤਿਆਰ ਕੀਤਾ ਜਾਂਦਾ ਹੈ ਜੀ ਸਰ ਆਪਣੀ ਲੋਕੇਸ਼ਨ ਹੈਗੀ ਆ ਖੰਨਾ ਜੀ ਡੀ ਪੀ ਮਾਰਕੀਟ ਦੇ ਵਿੱਚ ਅਤੇ ਸਰ ਤੁਸੀਂ ਕਦੋਂ ਦੀ ਵੇਟ ਕਰਦੇ ਜੀ ਅਤੇ ਮੈਨੂੰ ਕਾਲ ਕਰਕੇ ਕਨਫਰਮ ਕਰ ਦਿਓ ਕਦੋਂ ਦਾ ਤੁਹਾਡਾ ਆਈਡੀਆ ਵਿਜ਼ਿਟ ਕਰਨ ਦਾ ਹਾਂਜੀ ਹਾਂਜੀ ਸਰ ਕਦੋਂ ਵਿਜ਼ਿਟ ਕਰਨਾ ਤੁਸੀਂ ਅੱਛਾ ਅੱਛਾ ਜੀ ਸਰ ਕੋਈ ਨਾ ਕੋਲ ਕਰਕੇ ਆਇਓ ਤੁਹਾਡੇ ਲਈ ਮੈਂ ਇੱਕ ਸਪੈਸ਼ਲ ਟੇਬਲ ਖਾਲੀ ਕਰਾ ਦੂੰਗਾ ਜੀ ਹਾਂਜੀ ਹਾਂਜੀ ਸਰ ਕੋਈ ਬੁਕਿੰਗ ਚਾਰਜਰ ਨਹੀਂ ਚਾਰਜਿਸ ਨਹੀਂ ਹੁੰਦੇ ਇਹਦੇ ਓਕੇ ਥੈਂਕਸ ਫੋਰ ਕੋਲਿੰਗ ਸੀ ਯੂ ਟਾਟਾ ਬਾਏ